ਮੈਂ ਅਖਬਾਰਾਂ ਦੇ ਵਿੱਚੋਂ ਜਿਵੇਂ ਕਿ ਕੁਝ ਅਖਬਾਰਾਂ ਦੇ ਨਾਮ ਹਨ ਪੰਜਾਬੀ ਟ੍ਰਿਬਿਊਨ ਜਗ ਬਾਣੀ ਚੰਡੀਗੜ੍ਹ ਬਾਣੀ ਅਜੀਤ ਅਜਿਹੇ ਬਹੁਤ ਸਾਰੇ ਅਖਬਾਰ ਹਨ ਅਤੇ ਮੇਰੇ ਮਾਤਾ ਪਿਤਾ ਚੰਡੀਗੜ੍ਹ ਬਾਣੀ ਦੇ ਵਿੱਚੋਂ ਖਬਰਾਂ ਪੜ੍ਹਨੀਆਂ ਸੁਣਨੀਆਂ ਪਸੰਦ ਕਰਦੇ ਹਨ ਅਤੇ ਓਹਨਾਂ ਅਖਬਾਰਾਂ ਦੇ ਵਿੱਚ ਆਧੁਨਿਕ ਜੋ ਵੀ ਘਟਨਾ ਵਾਪਰਦੀ ਹੈ ਬਹੁਤ ਹੀ ਵਧੀਆ ਉਸ ਨਾਲ ਪ੍ਰਚਾਰ ਕੀਤਾ ਹੁੰਦਾ ਆ ਅਤੇ ਇਹਨਾਂ ਅਖਬਾਰਾਂ ਤੋਂ ਬਿਨਾਂ ਨਿਊਜ਼ ਚੈਨਲਾਂ ਦੇ ਵਿੱਚੋਂ ਆਜ ਤੱਕ ਅਤੇ ਨਿਊਜ਼ ਟਵੈਂਟੀ ਫੋਰ ਮੇਰੇ ਸਭ ਤੋਂ ਪਸੰਦੀਦਾ ਚੈਨਲ ਹਨ ਅਤੇ ਓਹਨਾਂ ਦੇ ਵਿੱਚ ਵਹੁਤ ਹੀ ਜ਼ਿਆਦਾ ਵਧੀਆ ਖਬਰਾਂ ਦਿੱਤੀਆਂ ਹੁੰਦੀਆਂ ਨੇ ਅਤੇ ਸੱਚਾਈ ਦਿੱਤੀ ਹੁੰਦੀ ਹੈ ਅਤੇ ਮਿੰਟ ਮਿੰਟ ਵਾਪਰੀ ਘਟਨਾ ਦੀ ਜਾਣਕਾਰੀ ਓਹਨਾਂ ਚੈਨਲਾਂ ਉੱਤੇੇ ਮਿਲ ਜਾਂਦੀ ਹੈ ਇਹ ਦੋ ਚੈਨਲ ਮੇਰੇ ਸਭ ਤੋਂ ਪਸੰਦੀਦਾ ਹਨ ਅਤੇ ਉੱਥੇ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਬਹੁਤ ਹੀ ਕੁਝ ਨਵਾਂ ਦੇਖਣ ਅਤੇ ਸੁਣਨ ਨੂੰ ਉੱਥੋਂ ਚੈਨਲਾਂ ਤੋਂ ਮਿਲਦਾ ਆ